ਸਤਿ ਸ਼੍ਰੀ ਅਕਾਲ ਜੀ ਹਾਂਜੀ ਅਤੇ ਤੁਸੀਂ ਕੌਣ ਓਕੇ ਕਿਹੜਾ ਯੀਅਰ ਹੈ ਤੁਹਾਡਾ ਠੀਕ ਆ ਹਾਂਜੀ ਤੁਸੀਂ ਹੋਸਟਲ ਵਿੱਚ ਅਜੇ ਕਮਰਾ ਤਾਂ ਨਹੀਂ ਲਿਆ ਠੀਕ ਆ ਅਤੇ ਜੇ ਤੁਸੀਂ ਇੰਨੀ ਦੂਰੋਂ ਆ ਰਹੇ ਹੋ ਤਾਂ ਇੱਥੇ ਆਪਣਾ ਮੌਸਮ ਦਾ ਇਹ ਹਿਸਾਬ ਹੈ ਵੀ ਜੇ ਤਾਂ ਗਰਮੀ ਆ ਹੈ ਨਾ ਤਾਂ ਗਰਮੀ 'ਚ ਮ ਕੋਟਨ ਦੇ ਕੱਪੜੇ ਜ਼ਿਆਦਾ ਰੱਖਿਓ ਕਿਉਂਕਿ ਗਰਮੀ ਬਹੁਤ ਜਿਆਦਾ ਹੁੰਦੀ ਹੈ ਇੱਥੇ ਅਤੇ ਜੇ ਸਿਆਲ ਦੀ ਗੱਲ ਕਰੀਏ ਤਾਂ ਠੰਡੀਆਂ ਹਵਾਵਾਂ ਜ਼ਿਆਦਾ ਚੱਲਦੀਆਂ ਕਿਉਂਕਿ ਆਪਣੇ ਫਤਿਹਗੜ੍ਹ ਸਾਹਿਬ ਦੇ ਲਾਗੇ ਅੱਗੇ ਰੂਪ ਰੂਪਨਗਰ ਰੋਪੜ ਹੈ ਤਾਂ ਉੱਧਰ ਪਹਾੜੀ ਇਲਾਕਾ ਵੀ ਆਉਂਦਾ ਠੀਕ ਤਾਂ ਠੰਡੀਆਂ ਹਵਾਵਾਂ ਵੀ ਜ਼ਿਆਦਾ ਚੱਲਦੀਆਂ ਨੇ ਅਤੇ ਜੇ ਬਰਸਾਤ ਦੀ ਗੱਲ ਕਰੀਏ ਤਾਂ ਬਰਸਾਤ ਦਾ ਮੌਸਮ ਜ਼ਿਆਦਾ ਚਿਪਚਿਪਾ ਰਹਿੰਦਾ ਅਤੇ ਬਰਸਾਤਾਂ 'ਚ ਇੱਥੇ ਇਸ ਸਾਲ ਤਾਂ ਹੜ੍ਹ ਵੀ ਆ ਕੇ ਹਟਿਆ ਅਤੇ ਆਪਣੇ ਫਤਿਹਗੜ੍ਹ ਸਾਹਿਬ ਇਸ ਸਾਲ ਹੜ੍ਹ ਆਇਆ ਅਤੇ ਤਾਂ ਤਾਂ ਕਰਕੇ ਜੇ ਤੁਸੀਂ ਹੋਸਟਲ ਦਾ ਕਮਰਾ ਅਜੇ ਤੱਕ ਨਹੀਂ ਲਿਆ ਨਾ ਤਾਂ ਕੋਸ਼ਿਸ਼ ਕਰਿਉ ਕਿ ਹੋਸਟਲ 'ਚ ਉੱਪਰਲੇ ਉੱਪਰਲੇ ਫਲੋਰ ਦਾ ਕਮਰਾ ਲਿਓ ਕਿਉਂਕਿ ਉ ਉਹ ਕਾਫੀ ਹੱਦ ਤੱਕ ਸਹੀ ਆ ਅਤੇ ਨੀਚੇ ਅਜੇ ਕੰਮ ਵੀ ਚੱਲਦਾ ਪਿਆ ਸਹੀ ਹੁੰਦਾ ਪਿਆ ਥੱਲੇ ਹਾਂਜੀ ਮੌਸਮ ਦੇ ਹਿਸਾਬ ਨਾਲ ਇੱਥੇ ਵੀ ਇੱਥੇ ਵੀ ਕਈ ਵਧੀਆ ਦੁਕਾਨਾਂ ਅਤੇ ਮੌਸਮ ਦੇ ਹਿਸਾਬ ਨਾਲ ਇੱਥੇ ਵੀ ਕੱਪੜੇ ਮਿਲਦੇ ਆ ਬਟ ਕੋਸ਼ਿਸ਼ ਕਰੋ ਕਿ ਜਿਵੇਂ ਹੈ ਨਾ ਤੁਸੀਂ ਐਨਾ ਦੂਰ ਦਾ ਸਫਰ ਤੈਅ ਕਰਕੇ ਆ ਰਹੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਮੌਸਮ ਨੂੰ ਦੇਖਦੇ ਹੋਏ ਉੱਥੋਂ ਹੀ ਕੱਪੜੇ ਲੈ ਕੇ ਆਉ ਜਿਵੇਂ ਕਿ ਗਰਮੀਆਂ 'ਚ ਤਾਂ ਕੋਟਨ ਦੇ ਕੱਪੜੇ ਪੈਂਦੇ ਆ ਤੁ ਤੁਸੀਂ ਵੀ ਉੱਧਰ ਕੇਰਲਾ ਵਾਲੀ ਸਾਈਡ ਤੋਂ ਆ ਤਾਂ ਉਹ ਉਹ ਵੀ ਪਾਣੀ ਦਾ ਉੱਧਰ ਵੀ ਮੀਂਹ ਮੂਹ ਜ਼ਿਆਦਾ ਪੈਂਦੇ ਨੇ ਤਾਂ ਫਿਰ ਉਹ ਇੱਧਰ ਵੀ ਹਿਸਾਬ ਆ ਚਿਪਚਿਪ ਅਤੇ ਆਹਾ ਗਰਮੀਆਂ ਦੀ ਬਾਹਲੀ ਗਰਮੀ ਤੇਜ਼ ਗਰਮੀ ਤਾਂ ਕੋਟਨ ਵਗੈਰਾ ਦੇ ਕੱਪੜੇ ਪੈਣਗੇ ਅਤੇ ਸਿਆਲ 'ਚ ਤਾਂ ਆਪਣੇ ਵੁਲਨ ਹੀ ਪੈਂਦਾ ਹੈਂਜੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਰਜਾਈਆਂ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਉਹ ਇੱਥੋਂ ਹੀ ਹੋਸਟਲ 'ਚੋਂ ਪ੍ਰੋਵਾਈਡ ਹੋ ਜਾਂਦਾ ਹੁੰਦਾ ਸਾਰਾ ਕੁਛ ਔਰ ਮੌਸਮ ਨੂੰ ਦੇਖਦੇ ਹੋਏ ਸਾਰੇ ਪ੍ਰਬੰਧ ਇੱਥੇ ਔਲ ਪਹਿਲਾਂ ਤੋਂ ਹੀ ਕ ਕਰਕੇ ਰੱਖਦੇ ਨੇ ਇਹ ਓਕੇ ਓਕੇ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ